ਮੈਂ ਮੈਰਾਥਨ ਵਿੱਚ ਵੀ ਹਿੱਸਾ ਲਿਆ ਹੈ ਅਤੇ ਆਪਣੇ ਮਿੱਤਰਾਂ ਦੇ ਨਾਲ ਮੈਰਾਥਨ ਵਿੱਚ ਦੌੜ ਲਗਾਈ ਹੈ ਮੈਰਾਥਨ ਦੌੜ ਲਗਾਉਣ ਤੋਂ ਪਹਿਲਾਂ ਮੈਂ ਆਪਣੇ ਮਿੱਤਰਾਂ ਨਾਲ ਮੰਡੀ ਅਤੇ ਮੰਡੀ ਵਿੱਚ ਰਨਿੰਗ ਲਈ ਜਾਂਦਾ ਹੁੰਦਾ ਸੀ ਅਤੇ ਰਨਿੰਗ ਲਗਾਉਣ ਲਈ ਅਸੀਂ ਕਈ ਕਈ ਟੈਮ ਵਿੱਚ ਰਨਿੰਗ ਲਗਾਉਂਦੇ ਰਹਿੰਦੇ ਸੀ ਅਤੇ ਉਨ੍ਹਾਂ ਵਿੱਚ ਅਸੀਂ ਰਨਿੰਗ ਲਗਾਉਣ ਨਾਲ ਸਾਡਾ ਤੰਦ ਸਰੀਰ ਅਤੇ ਤੰਦਰੁਸਤ ਰਹਿੰਦਾ ਹੈ ਇਸ ਨਾਲ ਸਾਡੀ ਫਿੱਟਨੈੱਸ ਵਿੱਚ ਵਧੀਆ ਹੁੰਦਾ ਹੈ ਇਸ ਨਾਲ ਸਾਡੇ ਸਰੀਰ ਤਾਕਤਵਰ ਅਤੇ ਮਜ਼ਬੂਤ ਬਣੇ ਰਹਿੰਦੇ ਹਨ ਅਸੀਂ ਜਦੋਂ ਸਕੂਲ ਟੈਮ ਵਿੱਚ ਗਰੋਂਡ ਵਿੱਚ ਖੇਡਦੇ ਸੀ ਅਸੀਂ ਉਸ ਟੈਮ ਵੀ ਰਨਿੰਗ ਲਗਾਉਂਦੇ ਸੀ ਤਾਂ ਕਿ ਸਾਡਾ ਸਰੀਰ ਫਿੱਟ ਰਹੇ ਅਤੇ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸ ਕਰਕੇ ਅਸੀਂ ਰਨਿੰਗ ਲਗਾਉਣਾ ਬਹੁਤ ਵਧੀਆ ਸਮਝਦੇ ਹਾਂ ਤਾਂ ਕਿ ਸਾਡੇ ਸਰੀਰ ਵਿੱਚ ਵਧੀਆ ਤਾਕਤ ਅਤੇ ਮਜ਼ਬੂਤੀਆਂ ਆਉਂਦੀਆਂ ਹਨ ਤਾਂ ਕਿ ਸਾਡਾ ਸਰੀਰ ਕਿਤੇ ਵੀ ਕੋਈ ਵੀ ਨੂੰ ਹੋ ਨਾ ਨੁਕਸਾਨ ਨਾ ਹੋਵੇ ਮੈਂ ਆਪਣੇ ਦੋਸਤਾਂ ਨਾਲ ਨੈੱਟਬੋਲ ਗੇਮ ਵਿੱਚ ਵੀ ਰਨਿੰਗ ਲਗਾਉਂਦਾ ਸੀ ਅਤੇ ਅਤੇ ਗੇਮ ਵੀ ਰਨਿੰਗ ਨਾਲ ਹੀ ਖੇਡੀ ਜਾਂਦੀ ਸੀ ਜਿਸ ਨਾਲ ਅਸੀਂ ਇੱਕ ਬੋਲ ਨੂੰ ਦੂਸਰੇ ਦੂਸਰੇ ਮਿੱਤਰ ਤੱਕ ਪਹੁੰਚਾਉਂਦੇ ਸੀ ਅਤੇ ਰਨਿੰਗ ਲਗਾਉਂਦੇ ਸੀ ਇਸ ਨਾਲ ਅਸੀਂ ਆਪਣੀ ਗੇਮ ਵਿੱਚ ਤਿਆ ਤਿਆਰ ਹੁੰਦੇ ਸੀ ਅਤੇ ਨਾਲੇ ਅਸੀਂ ਆਪਦੇ ਸਰੀਰ ਨੂੰ ਵਧੀਆ ਫਿੱਟ ਫਾਟ ਰੱਖਦੇ ਸੀ ਤਾਂ ਕਿ ਸਾਡਾ ਸਰੀਰ ਵਧੀਆ ਰਹੇ ਇਸ ਨਾਲ ਅਸੀਂ ਗੇਮ ਵਿੱਚ ਫੁੱਟਬੋਲ ਆਦਿ ਹੋਰ ਚੀਜ਼ਾਂ ਵੀ ਖੇਡ ਸਕਦੇ ਹਾਂ ਇਸ ਨਾਲ ਅਸੀਂ ਰਨਿੰਗ ਕਰਦੇ ਹਾਂ ਅਤੇ ਸਾਡਾ ਹੋਰ ਸਰੀਰਾਂ ਨਾਲੋਂ ਸਰੀਰ ਵਧੀਆ ਰਹਿੰਦਾ ਹੈ ਇਸ ਨਾਲ ਅਸੀਂ ਨੈਚੁਰਲ ਖੁਰਾਕ ਵੀ ਕਰ ਸਕਦੇ ਹਾਂ ਅਤੇ ਇਨ੍ਹਾਂ ਨੂੰ ਭੱਜਣ ਲਈ ਸਾਨੂੰ ਹਰੇਕ ਨੂੰ ਪ੍ਰੇਰਨਾ ਦਿੱਤ ਦੇਣੀ ਚਾਹੀਦੀ ਹੈ ਮੈਂ ਆਪਣੇ ਪਰਿਵਾਰ ਨਾਲ ਵੀ ਰੋਜ਼ਾਨਾ ਸਵੇਰ ਦੀ ਸੈਰ ਵਿੱਚ ਕਰਦਾ ਹਾਂ ਤਾਂ ਕਿ ਸ ਅਸੀਂ ਉਸ ਵੇਲੇ ਵੀ ਰਨਿੰਗ ਕਰਦੇ ਹਾਂ ਅਤੇ ਆਪਣਾ ਸਰੀਰ ਫਿੱਟ ਫਾਟ ਰੱਖਦੇ ਹਾਂ ਇਸ ਕਰਕੇ ਅਸੀਂ ਉਸ ਸਰੀਰ ਨੂੰ ਤੰਦਰੁਸਤ ਰਹਿੰਦੇ ਹਨ ਅਤੇ ਸਾਨੂੰ ਕੋਈ ਵੀ ਬਿਮਾਰੀਆਂ ਨਹੀਂ ਲੱਗਦੀਆਂ ਮੇਰਾ ਪਰਿਵਾਰ ਮੈਂ ਆਪਣੇ ਦਾਦਾ ਅਤੇ ਦਾਦੀ ਅਤੇ ਮੇਰੇ ਪਿਤਾ ਔਰ ਮੇਰੀ ਛੋਟੀ ਭੈਣ ਨਾਲ ਅਸੀਂ ਜਾਨੇ ਸਵੇਰੇ ਦੀ ਸੁਬਾਹ ਵਿੱਚ ਮੰਡੀ ਵਿੱਚ ਜਾਨੇ ਹਾਂ ਅਤੇ ਮੈਂ ਅਤੇ ਮੇਰੀ ਛੋਟੀ ਭੈਣ ਅਸੀਂ ਉੱਥੇ ਰਨਿੰਗ ਲਗਾਉਂਦੇ ਹਾਂ ਅਤੇ ਮੇਰੇ ਦਾਦਾ ਅਤੇ ਦਾਦੀ ਦੋਵੇਂ ਪੈਦਲ ਗੇੜੇ ਦਿੰਦੇ ਹਨ